ਪੰਜਾਬ ਦਾ ਮੁੱਖ ਕਿਰਤ ਸੈਕਟਰ ਕਿਸਾਨੀ ਅਤੇ ਕੈਨਿਟੀ ਕਲਚਰ ਹੈ ਇਹ ਇਸ ਖਾਂਗਾਂ ਅਤੇ ਪਾ ਵਪਾਰਾਂ ਨੂੰ ਸਹਿਯੋਗ ਦੇਣ ਲਈ ਸਰਕਾਰੀ ਨੀਤੀਆਂ ਦੀ ਵੀ ਵਧਾਈ ਹੈ ਪਰ ਇਹ ਸੈਕਟਰ ਕਈ ਚੁਣੌਤੀਆਂ ਅਤੇ ਰੋਜ਼ਾਨਾ ਦਾ ਸਾਹਮਣਾ ਕਰਦਾ ਹੈ ਕਿਸਾਨੀ ਸੈਕਟਰ ਵਿੱਚ ਪਹਿਲੇ ਵਿਚਾਰਾਂ ਵਿੱਚ ਇੱਕ ਚੰਗਾ ਮੁਨਾਫਾ ਹੈ ਪਰ ਇਹ ਚੁਣੌਤੀਆਂ ਹਨ ਜੋ ਉਸ ਨੂੰ ਉਸਦੇ ਰਸਤੇ ਵਿੱਚ ਹੁੰਦੀਆਂ ਨੇ ਵੱਡੇ ਦਰਜੇ 'ਤੇ ਖੇਤੀਬਾੜੀ ਲਈ ਜਮੀਨ ਦੀ ਅਦਾਇਗੀ ਅਤੇ ਪਾਣੀ ਦੇ ਸਰੋ ਸਰੋਤਾਂ ਨੂੰ ਸੰਭਾਲਣਾ ਕਈ ਸਮੱਸਿਆਵਾਂ ਹਨ ਵਣ ਵਣਜੀਕ ਕਿਸਾਨੀ ਵਿੱਚ ਉਹਨਾਂ ਨੂੰ ਅਨੁਭਵਸ਼ੀਲਤਾ ਅਤੇ ਨਵੇਂ ਤਕਨੀਕੀ ਕਰਜਦਾਰੀਆਂ ਵਿੱਚ ਨਵੇਂ ਅਨੁਭਵ ਦੀ ਲੋੜ ਹੁੰਦੀ ਹੈ ਖੇਤੀਬਾੜੀ ਸੈਕਟਰ ਵਿੱਚ ਬਣਨ ਵਾਲੇ ਤਕਨੀਕੀ ਪਰਿਵਰਤਨ ਅਤੇ ਮਾਰਕੀਟ ਦੀ ਚੰਗੀ ਸਮੇਂ ਨੂੰ ਵਧਾਉਣ ਲਈ ਕੁਦਰਤੀ ਖੇਤੀ ਅਤੇ ਕਿਸਾਨੀ ਵਿੱਚ ਨਵੀਂ ਤਕਨੀਕੀ ਪ੍ਰਗਤੀ ਦੀ ਲੋੜ ਹੈ ਕਿਰਤ ਸੈਕਟਰ ਵਿੱਚ ਵੀ ਇਹ ਹਾਲਤ ਚੰਗੇ ਨਹੀਂ ਹਨ ਪੰਜਾਬ ਦੇ ਯੁਵਾ ਨੂੰ ਨੌਕਰੀ ਪ੍ਰਾਪਤ ਕਰਨ ਲਈ ਵਿੱਦਿਆ ਅਤੇ ਕੌਸ਼ਲ ਦੀ ਅਧਿਕ ਜ਼ਰੂਰਤ ਹੈ ਇਹ ਵੀ ਇੱਕ ਮੁੱਖ ਚੁਣੌਤੀ ਹੈ ਕਿ ਨਵੇਂ ਯੁਵਾਵਾਂ ਨੂੰ ਉਹਨਾਂ ਨੂੰ ਪ੍ਰਿੰਸੀਪਲ ਨੂੰ ਸਮਝਣਾ ਅਤੇ ਪ੍ਰਤਿਭਾਸ਼ਾਲੀ ਅਤੇ ਨਵਚਾਰਕ ਸੋਚ ਨੂੰ ਵਧਾਵਾ ਦੇਣ ਲਈ ਤਿਆਰ ਕੀਤਾ ਜਾ ਰਿਹਾ ਅਤੇ ਵੱਧਦੀ ਕੰਪੀਟੀਸ਼ਨ ਅਤੇ ਸਮਰਾ ਵਿੱਚ ਸਮਰੱਥਾ ਦੇ ਮੁਤਾਬਿਕ ਉਹਨਾਂ ਨੂੰ ਆਪਣਾ ਧਿਆਨ ਦੇਣ ਦੀ ਲੋੜ ਹੈ ਇਸ ਵਾਸਤੇ ਉਹਨਾਂ ਨੂੰ ਉਹਨਾਂ ਦੀ ਸਹਿਯੋਗ ਨਾਲ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ